ਮੈਂ ਪਿਛਲੇ ਹਫ਼ਤੇ ਇੱਕ ਹੈਂਡਬੈਗ ਔਡਰ ਕੀਤਾ ਸੀਗਾ ਮਿੰਤਰਾ ਤੋਂ ਜਿਹਦਾ ਕਿ ਮੈਂ ਇੱਕ ਰਿਵਿਉ ਸ਼ੇਅਰ ਕਰਨਾ ਚਾਹੁੰਦੀ ਹਾਂ ਸੋ ਮੇਰਾ ਹੈਂਡਬੈਗ ਜੋ ਸੀਗਾ ਕੈਪਰੇਸੀ ਦਾ ਸੀਗਾ ਜਿਹੜਾ ਨਿਅਰ ਅਬਾਊਟ ਫੋਰ ਥਾਊਸੈਡ ਰੁਪੀਸ ਦਾ ਸੀਗਾ ਬਟ ਉਹ ਮੈਨੂੰ ਫਿਫਟੀ ਪਰਸੈਂਟ ਓਫ 'ਤੇ ਮਿਲਿਆ ਸੀਗਾ ਦੋ ਹਜ਼ਾਰ ਰੁਪਏ ਦਾ ਸੋ ਜਿਹਨੂੰ ਲੈ ਕੇ ਮੈਂ ਕਾਫੀ ਖੁਸ਼ ਸੀਗੀ ਅਤੇ ਐਕਸਾਇਟਿਡ ਸੀਗੀ ਕਿ ਇੱਕ ਬਹੁਤ ਅੱਛੇ ਬਰੈਂਡ ਦਾ ਬੈਗ ਮੈਂ ਖਰੀਦਿਆ ਓਰ ਉਹ ਵੀ ਬਹੁਤ ਘੱਟ ਪੈਸਿਆਂ 'ਚ ਪਰ ਜਦੋਂ ਉਹ ਪਰੋਡਕਟ ਆਇਆ ਮੈਂ ਉਸ ਤੋਂ ਜ਼ਿਆਦਾ ਐਕਸਾਈਟਿਡ ਹੋਈ ਸੀ ਪਰੋਡਕਟ ਨੂੰ ਦੇਖ ਕੇ ਕਿਉਂਕਿ ਮੇਰੇ ਬੈਗ ਦੀ ਕੁਆਲਿਟੀ ਬਹੁਤ ਅੱਛੀ ਸੀਗੀ ਔਰ ਇਸ ਤੋਂ ਇਲਾਵਾ ਜੋ ਉਹਦੀ ਪੈਕੇਜਿੰਗ ਸੀਗੀ ਓਰ ਡਿਲਵਰੀ ਏਜੰਟ ਸੀਗੇ ਉਹ ਵੀ ਬਹੁਤ ਵਧੀਆ ਸੀਗੇ ਉਹਨਾਂ ਦਾ ਬਿਹੇਵੀਅਰ ਵੀ ਬਹੁਤ ਵਧੀਆ ਸੀਗਾ ਸੋ ਜੋ ਪਰੋਡਕਟ ਸੀਗਾ ਮੈਂ ਪਿਛਲੇ ਇੱਕ ਮਹੀਨੇੇ ਤੋਂ ਯੂਸ ਕਰ ਰਹੀ ਹਾਂ ਓਰ ਉਹਦੀ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਹੈ ਓਰ ਬਹੁਤ ਵਧੀਆ ਉਹ ਚੱਲ ਰਿਹਾ ਹੈ ਜਿਸ 'ਚ ਨਿਅਰ ਅਬਾਊਟ ਮੈਂ ਵਨ ਕੇ ਜੀ ਤੱਕ ਆਪਣਾ ਕਹਿ ਲਉ ਸਮਾਨ ਕੈਰੀ ਕਰ ਸਕਦੀ ਹਾਂ ਓਰ ਉਹ ਮੈਨੂੰ ਕਾਫੀ ਯੂਸਫੁੱਲ ਵੀ ਲੱਗਿਆ ਜਿਸ 'ਚ ਕਾਫੀ ਸਾਰੀਆਂ ਛੋਟੀਆਂ ਛੋਟੀਆਂ ਪੋਕਿਟਸ ਵੀ ਨੇ ਜਿਸ 'ਚ ਮੈਂ ਆਪਣੇ ਇਜ਼ੀਲੀ ਮੋਬਾਇਲ ਫੋਨ ਕੈਰੀ ਕਰ ਸਕਦੀ ਹਾਂ ਆਪਣੀ ਅਸੈਸਰੀ ਕੈਰੀ ਕਰ ਸਕਦੀ ਹਾਂ ਆਪਣੀ ਪੈਨਸਿਲ ਬੋਕਸ ਹੋ ਗਏ ਜਾਂ ਪੈੱਨਸ ਹੋ ਗਏ ਓਰ ਕਾਫੀ ਕੁਛ ਇਵਨ ਮੈਂ ਆਪਣੀ ਵਾਟਰ ਬੋਟਲ ਵੀ ਕੈਰੀ ਕਰ ਸਕਦੀ ਹਾਂ ਸੋ ਮੈਂ ਓਵਰਆਲ ਇਹ ਕਹਿ ਸਕਦੀ ਹਾਂ ਕਿ ਜੋ ਮੇਰਾ ਬੈਗ ਸੀਗਾ ਉਹ ਬਹੁਤ ਅੱਛਾ ਹੈ ਓਰ ਮਿੰਤਰਾ ਦੇ ਜੋ ਪਰੋਡਕਟਸ ਨੇ ਉਹ ਕਾਫੀ ਅੱਛੇ ਨੇ ਸੋ ਬਿਨਾਂ ਕਿਸੇ ਵੀ ਝਿਜਕ ਤੋਂ ਸਾਰੇ ਹੀ ਉਹ ਪਰੋਡਕਟਸ ਕੀ ਹੈ ਲੈ ਸਕਦੇ ਨੇ ਓਰ ਉਹਨਾਂ ਦੀ ਕੁਆਲਟੀ ਬਹੁਤ ਅੱਛੀ ਹੈ